ਅੱਜ ਕੱਲ੍ਹ ਬਹੁਤ ਸਾਰੀਆਂ ਬਿਮਾਰੀਆਂ ਫੈਲ ਗਈਆਂ ਹਨ ਜਿ ਜਿਸ ਵਿੱਚ ਬੁਖਾਰ ਚਿਕਨਗੁਨੀਆ ਡੇਂਗੂ ਦੀਆਂ ਬਿਮਾਰੀਆਂ ਹਨ ਉਹਨਾਂ ਵਿੱਚੋਂ ਇੱਕ ਕਬਜ਼ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੈ ਕਬਜ਼ ਨਾਲ ਪੇਟ ਸਾਫ਼ ਨਹੀਂ ਰਹਿੰਦਾ ਅਤੇ ਕਬਜ਼ ਦੇ ਇਲਾਜ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਅਤੇ ਰਾਤ ਨੂੰ ਛਿਲਕਾ ਖਾਣਾ ਚਾਹੀਦਾ ਹੈ ਗਰਮ ਦੁੱਧ ਨਾਲ ਅਤੇ ਫਲ ਫਰੂਟ ਖਾਣੇ ਚਾਹੀਦੇ ਹਨ ਜਿਸ ਕਰਕੇ ਸਾਡਾ ਪੇਟ ਸਾਫ਼ ਰਹਿੰਦਾ ਹੈ ਮੇਰੀ ਮੰਮੀ ਨੇ ਆਯੁਰਵੇਦਿਕ ਚੀਜ਼ਾਂ ਨਾਲ ਚੂਰਨ ਬਣਾਇਆ ਹੈ ਅਤੇ ਜੋ ਕਿ ਕਬਜ਼ ਦੂਰ ਕਰਨ ਦੇ ਕੰਮ ਆਉਂਦਾ ਹੈ ਇਹ ਘਰੇਲੂ ਨੁਸਖੇ ਹਨ